ਹਰ ਇੱਕ ਸਮਾਜ ਵਿੱਚ ਰਹਿਣ ਵਾਲੇ ਲੋਕ ਆਪਣੀ ਸੱਭਿਆਚਾਰਿਕ ਵਿਰਾਸਤ ਨੂੰ ਅਤੇ ਆਪਣੀ ਸਮਝ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਅਲੱਗ ਅਲੱਗ ਰਾਹ ਅਪਣਾਉਂਦੇ ਹਨ ਭੰਗੜਾ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਲਈ ਆਪਣੇ ਸੱਭਿਆਚਾਰਕ ਵਿਰਾਸਤ ਅਤੇ ਆਪਣੀ ਖੁਸ਼ੀ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਭੰਗੜਾ ਅਤੇ ਗਿੱਧਾ ਇਹ ਅਹਿਮ ਭੂਮਿਕਾ ਨਿਭਾਉਂਦੇ ਹਨ ਅਤੇ ਭੰਗੜਾ ਐਰੋਬਿਕਸ ਦੇ ਵਾਧੇ ਦੇ ਲਈ ਜੋ ਅਸੀਂ ਕਰ ਸਕਦੇ ਹਾਂ ਅਸੀਂ ਵੱਖ ਵੱਖ ਇਲਾਕਿਆਂ ਵਿੱਚ ਭੰਗੜੇ ਦੇ ਅਤੇ ਗਿੱਧੇ ਦੇ ਕੰਸਰਟ ਚਾਲੂ ਕਰਵਾ ਸਕਦੇ ਹਾਂ ਲੋਕਾਂ ਦੇ ਵਿੱਚ ਬੱਚਿਆਂ ਦੇ ਵਿੱਚ ਬੁੱਢਿਆਂ ਦੇ ਵਿੱਚ ਇਸ ਦੇ ਸੰਬੰਧ ਵਿੱਚ ਜਵਾਨਾਂ ਦੇ ਵਿੱਚ ਭੰਗੜੇ ਦੇ ਮੁਕਾਬਲੇ ਕਰਵਾਏ ਜਾ ਸਕਦੇ ਹਨ ਜਿਨ੍ਹਾਂ ਦੇ ਨਾਲ ਉਹਨਾਂ ਦਾ ਸਰੀਰਿਕ ਵਿਕਾਸ ਬੌਧਿਕ ਵਿਕਾਸ ਅਤੇ ਮਾਨਸਿਕ ਵਿਕਾਸ ਅਤੇ ਨਾਲ ਹੀ ਨਾਲ ਉਹਨਾਂ ਦੀ ਜੋ ਵਿਰਾਸਤ ਹੈ ਉਸ ਦੀ ਸਾਜ ਸੰਭਾਲ ਬਹੁਤ ਹੀ ਵਧੀਆ ਤਰੀਕੇ ਨਾਲ ਹੋ ਸਕੇਗੀ